ਸਾਡਾ ਜ਼ਿਲ੍ਹਾ ਰੋਪੜ ਜੋ ਕਿ ਸਿੰਧੂ ਘਾਟੀ ਦੀ ਸੱਭਿਅਤਾ ਨਾਲ ਜੁੜਿਆ ਹੋਇਆ ਹੈ ਇਸ ਦੇ ਸੰਬੰਧ ਵਿੱਚ ਕਿਸੇ ਨੂੰ ਵੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਸਰਕਾਰੀ ਕੋਲਜ ਗੌਵਰਮਿੰਟ ਸਰਕਾਰੀ ਕੋਲਜ ਦੇ ਮੂਹਰੇ ਇੱਕ ਮਿਊਜ਼ੀਅਮ ਹੈ ਉੱਥੋਂ ਜੋ ਵੀ ਅਜੋਕੇ ਸਮੇਂ ਦੇ ਸਿੱਕੇ ਜੋ ਵੀ ਸਿੰਧੂ ਘਾਟੀ ਦੀ ਸਭਿਅਤੀ ਸੱਭਿਅਤਾ ਦੀ ਖੁਦਾਈ ਸਮੇਂ ਜੋ ਵੀ ਕੁਝ ਮਿਲਿਆ ਸਿੱਕੇ ਮਿਲੇ ਆ ਪੁਰਾਣੀਆਂ ਕਹੀਆਂ ਦਾਤੀਆਂ ਮਿਲੀਆਂ ਖੋਜ ਕਰਨ ਤੋਂ ਬਾਅਦ ਉਹਦੀ ਜੋ ਵੀ ਇਨਫੋਰਮੇਸ਼ਨ ਮਿਲ ਲੈਣੀ ਚਾਹੁੰਦਾ ਹੋਵੇ ਤਾਂ ਉੱਥੋਂ ਮਿਲ ਸਕਦੀ ਹੈ ਉਸ ਤੋਂ ਬਾਅਦ ਜਿਵੇਂ ਕੀ ਅਸੀਂ ਕੋਈ ਖਬਰਾਂ ਸ ਸੁਣਨੀਆਂ ਹੈ ਆਪਣੇ ਜ਼ਿਲ੍ਹੇ ਦੀਆਂ ਜਾਂ ਫੇਰ ਪੜ੍ਹਨੀਆਂ ਤਾਂ ਉਹ ਸਾਡੇ ਅਖ਼ਬਾਰ ਜਿਹੜੇ ਆਉਂਦੇ ਹਾਂ ਜਿੱਦਾਂ ਅਜੀਤ ਅਖ਼ਬਾਰ ਆਉਂਦਾ ਜੱਗ ਬਾਣੀ ਉਹਦੇ ਵਿੱਚ ਇੱਕ ਸਪੈਸ਼ਲ ਪੇਜ ਬਣਿਆ ਹੁੰਦਾ ਸਾਡੇ ਜ਼ਿਲ੍ਹੇ ਰੋਪੜ ਦਾ ਉਹਦੇ ਵਿੱਚ ਤੁਹਾਡੇ ਜੋ ਵੀ ਰੋਪੜ ਦੇ ਵਿੱਚ ਚੱਲ ਰਿਹਾ ਹੈ ਉਹ ਖਬਰਾਂ ਤੁਸੀਂ ਉਥੋਂ ਪੜ੍ਹ ਜਾਂ ਸੁਣ ਲਿਖ ਸਕਦੇ ਹਾਂ ਬਾਕੀ ਸਾਡੇ ਜ਼ਿਲ੍ਹੇ ਦੇ ਵਿੱਚ ਥੋੜ੍ਹਾ ਜਿਹਾ ਦੇਖਣ ਵਾਲੀ ਗੱਲ ਹੈ ਕਿ ਜੋ ਮੀਡੀਆ ਹੈ ਮੀਡੀਆ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਵੀ ਧਿਆਨ ਦੋਣ ਦੇਣ ਦੀ ਲੋੜ ਹੈ ਜੋ ਕਿ ਆਉਣ ਜਾਣ ਦੇ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੇ ਮੀਡੀਆ ਇਹ ਚੀ ਸਭ ਚੀਜਾਂ ਦਿਖਾਵੇ ਸਰਕਾਰ ਤੱਕ ਪਹੁੰਚੇ ਤਾਂ ਪਿੰਡਾਂ ਦੇ ਆਉਣ ਜਾਣ ਦੇ ਲੋਕਾਂ ਨੂੰ ਜਿਹੜਾ ਰਸਤਾ ਲੱਗਦਾ ਹੈ ਤਾਂ ਉਹ ਸਹੀ ਤਾਂ ਕਿ ਉਹ ਸਹੀ ਹੋ ਸਕੇ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ